ਪੰਜਾਬ ਵਿੱਚ ਮੌਸਮ ਵੈਸੇ ਤਾਂ ਬਹੁਤ ਹੀ ਵਧੀਆ ਰਹਿੰਦੇ ਹੈ ਇੱਥੇ ਮੌਸਮ ਬਦਲਦੇ ਰਹਿੰਦੇ ਹੈ ਕਦੀ ਗਰਮੀ ਕਦੀ ਸਰਦੀ ਕਦੀ ਬਰਸਾਤ ਗਰਮੀ ਵਿੱਚ ਕੁਝ ਮੁਸ਼ਕਲਾਂ ਹੁੰਦੀਆਂ ਹਨ ਪਰ ਸਰਦੀ ਦੇ ਮੌਸਮ ਵਿੱਚ ਸੈਲਾਨੀਆਂ ਦੇ ਘੁੰਮਣ ਫਿਰਨ ਲਈ ਸਹੀ ਹਨ ਗਰਮੀ ਵਿੱਚ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਗਰਮੀ ਵਿੱਚ ਧੂੜ ਘੱਟਾ ਬਹੁਤ ਹੁੰਦਾ ਹੈ ਜੋ ਇੱਥੇ ਰਹਿੰਦੇ ਲੋਕਾਂ ਲਈ ਮੁਸ਼ਕਲ ਹੋਇਆ ਹੁੰਦਾ ਹੈ ਸੈਲਾਨੀਆਂ ਲਈ ਕਾਫ਼ੀ ਮੁਸ਼ਕਲਾਂ ਹੁੰਦੀਆਂ ਹਨ ਇਸ ਲਈ ਸਰਦੀ ਦਾ ਮੌਸਮ ਤੋਂ ਬਰਸਾਤੀ ਮੌਸਮ ਸੈਲਾਨੀਆਂ ਦੇ ਘੁੰਮਣ ਫਿਰਨ ਲਈ ਬਹੁਤ ਸਹੀ ਹਨ ਇਸ ਸੈਲਾਨੀਆਂ ਨੂੰ ਸਰਦੀ ਵਿੱਚ ਹੀ ਪੰਜਾਬ ਆਉਣਾ ਚਾਹੀਦਾ ਹੈ